ਹਾਂ ਬਾਗਬਾਨੀ ਲਈ ਜਿਹੜੇ ਆਪਾਂ ਸੰਦ ਵਰਤਦੇ ਹਾਂ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਆਪਾਂ ਸਾਰੇ ਹੀ ਬਾਗਬਾਨੀ ਦੇ ਸ਼ੌਕੀਨ ਹੁੰਦੇ ਹਾਂ ਅਤੇ ਇਹਦੇ ਵਿੱਚ ਆਪਾਂ ਜਿਵੇਂ ਕਿ ਕਹੀ ਰੰਬੀ ਬਰਮਾ ਮਸ਼ੀਨਾਂ ਹੋ ਗਈਆਂ ਇਵੇਂ ਦੀਆਂ ਚੀਜ਼ਾਂ ਵਰਤਦੇ ਹਾਂ ਜਦੋਂ ਆਪਾਂ ਕਿਸੇ ਪੌਦੇ ਦੀ ਮਤਲਬ ਕਿ ਉਹਨੂੰ ਗੋਡੀ ਦੇਣੀ ਹੁੰਦੀ ਆ ਅਤੇ ਫਿਰ ਆਪਾਂ ਰੰਬੀ ਦੀ ਵਰਤੋਂ ਕਰਦੇ ਹਾਂ ਜੇ ਆਪਾਂ ਉਹਦੀ ਖੁਦਾਈ ਕਰਨੀ ਤਾਂ ਫਿਰ ਆਪਾਂ ਕਹੀ ਵਰਤਦੇ ਹਾਂ ਅਤੇ ਜਦੋਂ ਆਪਾਂ ਪੌਦੇ ਦੀ ਜੜ੍ਹ ਨੂੰ ਮਤਲਬ ਕਿ ਮਿੱਟੀ ਦੇ ਵਿੱਚ ਲਗਾਉਣਾ ਅਤੇ ਆਪਾਂ ਨੂੰ ਬਰਮੇ ਦੀ ਸਹਾਇਤਾ ਦੇ ਨਾਲ਼ ਹੀ ਆਪਾਂ ਉਹ ਚੀਜ਼ ਕਰ ਸਕਦੇ ਹਾਂ ਫਿਰ ਸਪਰੇਅ ਪੰਪ ਹੁੰਦੇ ਆ ਜਿਹੜੀਆਂ ਜਿੱਦਾਂ ਕਿ ਆਪਾਂ ਘਰ ਵਿੱਚ ਤ ਤਾਜ਼ੀਆਂ ਸਬਜ਼ੀਆਂ ਲਗਾ ਕੇ ਖਾਣ ਦੇ ਸ਼ੌਕੀਨ ਹੁੰਦੇ ਹਾਂ ਅਤੇ ਫਿਰ ਆਪਾਂ ਨੂੰ ਸਪਰੇਅ ਕਰਨੀ ਪੈਂਦੀ ਆ ਇਹਨਾਂ ਨੂੰ ਜਿਹੜੀਆਂ ਮੌਸਮ ਦੇ ਅਨੁਸਾਰ ਜਿਹੜੀਆਂ ਵਾ ਇੱਥੇ ਮਤਲਬ ਕਿ ਸੁੰਡੀਆਂ ਜਾਂ ਹੋਰ ਵੀ ਕਈ ਹੁੰਦੇ ਆ ਜਿਹੜੇ ਜੀਵ ਜੰਤੂ ਜੇ ਇਹਨਾਂ ਨੂੰ ਪੈ ਜਾਂਦੇ ਆ ਅਤੇ ਫਿਰ ਆਪਾਂ ਨੂੰ ਸਪਰੇਅ ਦੇ ਨਾਲ਼ ਇਹਨਾਂ 'ਤੇ ਮਤਲਬ ਕਿ ਛਿੜਕਾਅ ਕਰਨਾ ਪੈਂਦਾ ਵਾ ਫਿਰ ਜਿਵੇਂ ਕਿ ਆਪਾਂ ਵੇਖਦੇ ਹਾਂ ਕਿਸੇ ਵੇਲੇ ਵੱਡੇ ਵੱਡੇ ਦਰੱਖ਼ਤ ਹੁੰਦੇ ਆ ਉਹ ਤਾਂ ਆਪਾਂ ਕੱਟ ਨਹੀਂ ਸਕਦੇ ਦਾਤਰ ਹੋ ਗਿਆ ਇਹਦੇ ਨਾਲ਼ ਤਾਂ ਕੱਟਿਆ ਜਾਣਾ ਨਹੀਂ ਅਤੇ ਸਮਾਂ ਜਿਹੜਾ ਵਾ ਹੁਣ ਤੁਹਾਨੂੰ ਪਤਾ ਹੀ ਆ ਮਸ਼ੀਨਾਂ ਵੱਖ ਵੱਖ ਤਰ੍ਹਾਂ ਦੀਆਂ ਆ ਚੁੱਕੀਆਂ ਅਤੇ ਫਿਰ ਵਿੱਚਕਾਰੋਂ ਰੁੱਖ ਨੂੰ ਕੱਟਣ ਦੇ ਲਈ ਆਪਾਂ ਜਿਹੜਾ ਵਾ ਪੀ ਉਹ ਮਸ਼ੀਨ ਦੀ ਵਰਤੋਂ ਕਰਦੇ ਹਾਂ ਵੱਡੀ ਮਸ਼ੀਨ ਦੀ ਉਹਦੇ ਨਾਲ਼ ਕਟਰ ਲੱਗਾ ਹੁੰਦਾ ਵਾ ਉਹ ਆਸਾਨੀ ਦੇ ਨਾਲ਼ ਵਿਚਕਾਰੋਂ ਵਿਚਕਾਰੋਂ ਜਿਹੜਾ ਵਾ ਉਹ ਕੱਟਿਆ ਜਾਂਦਾ ਵਾ ਇਹਦੇ ਨਾਲ਼ ਹੀ ਘਾਹ ਨੂੰ ਆਪਾਂ ਘਾਹ ਦੀ ਕਟਾਈ ਕਰਨ ਦੇ ਲਈ ਵੀ ਆਪਾਂ ਮਸ਼ੀਨ ਦੀ ਵਰਤੋਂ ਕਰਦੇ ਹਾਂ ਫਿਰ ਕੁਝ ਰੁੱਖ ਹੁੰਦੇ ਆ ਜਿਵੇਂ ਕਿ ਉਹਨਾਂ ਦੀਆਂ ਟਾਹਣੀਆਂ ਜ਼ਿਆਦਾ ਨੀਚੇ ਲੱਗਦੀਆਂ ਵਾ ਆਮ ਬੰਦਾ ਤਾਂ ਉਹਦੇ ਉੱਤੇ ਚੜ੍ਹ ਕੇ ਉਹਨੂੰ ਉਹਦੀ ਕਟਾਈ ਕਰ ਨਹੀਂ ਸਕਦਾ ਇਹਦੇ ਲਈ ਕੀ ਹੁੰਦਾ ਵਾ ਕਿ ਛੜੀ ਹੁੰਦੀ ਆ ਉਹ ਆਪਾਂ ਜ਼ਮੀਨ 'ਤੇ ਖਲੋ ਕੇ ਹੀ ਉੱਪਰ ਟਾਹਣੀ ਦੇ ਵਿੱਚ ਆਪਾਂ ਉਹਨੂੰ ਅੜਾ ਕੇ ਅਤੇ ਉਹਦੇ ਨਾਲ਼ ਆਪਾਂ ਉਹਨੂੰ ਆਸਾਨੀ ਨਾਲ਼ ਕੱਟ ਸਕਦੇ